ਪੰਜਾਬ ਵਿੱਚ ਜ਼ਿਲ੍ਹਾ ਵਾਈਜ਼ ਪਹਿਲਕਦਮੀਆਂ ਕੀਤੀ ਜਾਂਦੀਆਂ ਖੇਤੀ ਅਫ਼ਸਰ ਆ ਕੇ ਉਹਨਾਂ ਵਿੱਚ ਜ਼ਿਲ੍ਹਾ ਵੇਜ਼ ਇੱਕ ਥਾਂ 'ਤੇ ਪ੍ਰੋਗਰਾਮ ਰੱਖਿਆ ਜਾਂਦਾ ਹੈ ਜਿਸ ਵਿੱਚ ਕਿਸਾਨ ਭਰਾ ਇਕੱਠੇ ਹੁੰਦੇ ਹਨ ਅਤੇ ਉਹਨਾਂ ਵਿੱਚ ਉਹਨਾਂ ਨੂੰ ਬੀਜ ਬਾਰੇ ਅਤੇ ਦਵਾਈਆਂ ਬਾਰੇ ਪੂਰੀ ਸਲਾਹ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਪੂਰਾ ਆਪਣੇ ਅਨਾਜ ਦਾ ਮੁਆਵਜ਼ਾ ਬਾਰੇ ਸੰਬੰਧੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਜ ਲੁਧਿਆਣਾ ਯੂਨੀ ਯੂਨੀਵਰਸਿਟੀ ਆ ਖੇਤੀਬਾੜੀ ਯੂਨੀਵਰਸਿਟੀ ਆ ਉੱਥੇ ਵੀ ਜਾ ਕੇ ਆਪਣੇ ਅਫ਼ਸਰਾਂ ਤੋਂ ਤੋਂ ਖੇਤੀਬਾੜੀ ਬਾਰੇ ਸਲਾਹ ਦਿੱਤੀ ਜਾਂਦੀ ਹੈ ਜਿਵੇਂ ਆਪਣੇ ਸਰਕਾਰੀ ਵੱਲੋਂ ਕੋਈ ਵੀ ਸਹੂਲਤ ਦਿੱਤੀ ਜਾਂਦੀ ਹੈ ਉਹਨਾਂ ਬਾਰੇ ਕਿਵੇਂ ਸਬਸਿਡੀਆਂ ਜਾਂ ਹੋਰ ਖਾਦ ਬਾਰੇ ਸਬਸਿਡੀਆਂ ਜਾਂ ਚੰਗੇ ਬੀਜ ਜਾਂ ਚੰਗੀਆਂ ਖਾਦਾਂ ਬਾਰੇ ਸਲਾਹ ਦਿੱਤੀ ਜਾਂਦੀ ਹੈ ਤਾਂ ਕਿਹੜਾ ਬੀਜ ਕਿਹੜੇ ਮੌਸਮ ਅਨੁਸਾਰ ਬੀਜਿਆ ਜਾਂਦਾ ਏ ਜਾਂ ਕਿਹੜੀ ਫ਼ਸਲ ਕਿਹੜੇ ਮੌਸਮ ਅਨੁਸਾਰ ਹੋਣੀ ਚਾਹੀਦੀ ਹੈ ਤਾਂ ਜਾਂ ਇਹਦਾ ਕਿੰਨਾਂ ਝਾੜ ਆਉਂਦਾ ਇਹਦਾ ਕਿੰਨਾਂ ਝਾੜ ਆਉਂਦਾ ਉਹਦੇ ਬਾਰੇ ਮ ਖੇਤੀਬਾੜੀ ਅਫ਼ਸਰ ਹੈ ਚਾਹੇ ਚੰਗੀ ਜਾਂ ਸੰਖੇਪ ਦੇ ਵਿੱਚ ਡਿਟੇਲ ਦੇ ਵਿੱਚ ਸਮਝਾਉਂਦੇ ਹਨ